ਮੈਂ ਜਿਨ੍ਹਾਂ ਗੱਲਾਂ ਬਾਰੇ ਲਿਖਣਾ ਚਾਹੁੰਦੀ ਉਹ ਇਹ ਆ ਕਿ ਜਿਹੜੇ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਭੇਦ ਭਾਵ ਕਰਦੇ ਹਨ ਭੇਦ ਭਾਵ ਇਹ ਨਹੀਂ ਜਾਤ ਪਾਤ ਦਾ ਭੇਦ ਭਾਵ ਬਹੁਤ ਚੀਜ਼ਾਂ ਦਾ ਹੋਰ ਵੀ ਹਨ ਠੀਕ ਹੈ ਜਾਤ ਪਾਤ ਤਾਂ ਚਲੋ ਅੱਜ ਕੱਲ੍ਹ ਬਹੁਤ ਅੱਗੇ ਨਾਲੋਂ ਘੱਟ ਗਿਆ ਲੇਕਿਨ ਜਿਹੜੇ ਲੋਕ ਜਿੱਦਾਂ ਕਿਸੇ ਨੂੰ ਉਹਦੇ ਫਿਜੀਕਲੀ ਸਰੀਰਿਕ ਤੌਰ 'ਤੇ ਉਹਨਾਂ ਨੂੰ ਭੇਦ ਭਾਵ ਕਰਦੇ ਹਨ ਮੈਨੂੰ ਇਹ ਚੀਜ਼ ਬਿਲਕੁਲ ਨਹੀਂ ਪਸੰਦ ਮੈਂ ਇਹ ਚੀਜ਼ ਬਾਰੇ ਲਿਖਣਾ ਚਾਹੁੰਦੀ ਹਾਂ ਇਹ ਮੈਂ ਸਮਾਜ ਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਵੀ ਇਨਸਾਨ ਦੇ ਰੰਗ ਨੂੰ ਅਤੇ ਉਸਦੇ ਰੂਪ ਨੂੰ ਲੈ ਕੇ ਉਸਨੂੰ ਕਦੀ ਵੀ ਨਾ ਜੱਜ ਕਰੋ ਹਮੇਸ਼ਾਂ ਹਰ ਇਨਸਾਨ ਦਾ ਉਹਦਾ ਜੋ ਵੀ ਉਹਦਾ ਵਰਤਾਵ ਹੈ ਜੋ ਉਹਦੀ ਖੂਬੀ ਹੈ ਉਸ ਚੀਜ਼ ਨੂੰ ਮੈਂ ਕਿ ਹਮੇਸ਼ਾ ਉਹ ਕਰਨਾ ਚਾਹੀਦਾ ਹੈ ਕਿ ਹਾਂ ਕਿ ਇਹ ਚੀਜ਼ ਤੇਰੀ ਵਧੀਆ ਹੈ ਤੂੰ ਵਧੀਆ ਬੰਦਾ ਹੈ ਵਧੀਆ ਇਨਸਾਨ ਹੈ ਨਾ ਕਿ ਇਸ ਚੀਜ਼ ਨਾਲ ਤੇਰਾ ਰੰਗ ਕਾਲਾ ਹੈ ਤੂੰ ਪਤਲਾ ਹੈ ਤੂੰ ਮੋਟਾ ਹੈ ਯਾਰ ਤੂੰ ਕਿੰਨਾ ਪਤਲਾ ਤੂੰ ਹੱਡੀ ਬਣੀ ਜਾਂਦਾ ਹੈ ਇਹ ਚੀਜ਼ ਨਾ ਬਿਲਕੁਲ ਵੀ ਵਧੀਆ ਨਹੀਂ ਹਨ ਸਮਾਜ ਇਹਨਾਂ ਗੱਲਾਂ ਨੂੰ ਭੇਦ ਭਾਵ ਨੂੰ ਦੂਰ ਕਰੇ ਇਹ ਸਮਾਜ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਭੇਦ ਭਾਵ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਸੋਚਣਾ ਚਾਹੀਦਾ ਕੀ ਇਹਨਾਂ ਚੀਜ਼ਾਂ ਨੂੰ ਅਸੀਂ ਥੋੜਾ ਘਟਾ ਸਕੀਏ ਤੇ ਦੂਸਰੀ ਗੱਲ ਇਹ ਕਿ ਹਰ ਇਨਸਾਨ ਦੀ ਆਪਣੀ ਇੱਕ ਫੀਚਰ ਹੁੰਦੀ ਹੈ ਆਪਣੀ ਇੱਕ ਖੂਬੀ ਹੁੰਦੀ ਹੈ ਜਿਸਨੂੰ ਅਸੀਂ ਹਮੇਸ਼ਾ ਬਾਹਰੋਂ ਨੀ ਦੇਖ ਸਕਦੇ ਅਸੀਂ ਅੰਦਰੂਨੀ ਜਿਹੜੀ ਇਨਸਾਨ ਦੀ ਖੂਬੀ ਹੁੰਦੀ ਐ ਉਹ ਹਮੇਸ਼ਾ ਉਭਰ ਕੇ ਬਾਅਦ ਚ ਈ ਆਂਦੀ ਹੈ ਇਸ ਕਰਕੇ ਕਦੀ ਵੀ ਉਸਨੂੰ ਬਾਹਰੋਂ ਨਹੀਂ ਜੱਜ ਕਰਨਾ ਚਾਹੀਦਾ ਇਹ ਹੀ ਚੀਜ਼ ਮੈਂ ਸਮਾਜ ਨੂੰ ਦੱਸਣਾ ਚਾਹੁੰਦੀ ਹਾਂ ਕਿ ਡੋਂਟ ਅ ਜੱਜ ਪਰਸਨ ਬਾਏ ਇਟਸ ਆ ਆਊਟਸਾਈਡ